ਰੂਪਨਗਰ ਜ਼ਿਲ੍ਹੇ ਵਿੱਚ ਬਹੁਤ ਸੈਲਾਨੀ ਆਕਰਸ਼ਣ ਸਥਾਨ ਹਨ ਜਿਨ੍ਹਾਂ ਵਿੱਚੋਂ ਇੱਕ ਸਤਲੁਜ ਦਰਿਆ ਮੇਨ ਹੈ ਸਤਲੁਜ ਦਰਿਆ ਜੋ ਕਿ ਮਤਲਬ ਕਿ ਬਹੁਤ ਪੁਰਾਣਾ ਹੈ ਇਸ 'ਤੇ ਬਣਾਇਆ ਹੋਇਆ ਪੁਲ ਜੋ ਕਿ ਲੋਕ ਬਹੁਤ ਦੂਰ ਦੂਰ ਤੋਂ ਦੇਖਣ ਆਉਂਦੇ ਨੇ ਅਤੇ ਇੱਥੇ ਮਤਲਬ ਨੈਚੁਰਲ ਕੁਦਰਤੀ ਸਰੋਤ ਨੇ ਜਿਵੇਂ ਕਿ ਜੰਗਲ ਨੇ ਹੋਰ ਵੀ ਬਹੁਤ ਮਤਲਬ ਮਹੱਤਵਪੂਰਨ ਸਥਾਨ ਨੇ ਜਿਵੇਂ ਕਿ ਗੱਲ ਕਰੀਏ ਸੱਭਿਆਚਾਰ ਦੀ ਸੱਭਿਆਚਾਰ ਦਾ ਇੱਥੇ ਸਿੱਧੂ ਘਾਟੀ ਦੀ ਸੱਭਿਅਤਾ ਵੀ ਹੈ ਜਿਸ ਨੂੰ ਲੋਕ ਦੇਖਣ ਆਉਂਦੇ ਨੇ ਅਤੇ ਮ ਉਹਨਾਂ ਦੇ ਪੁਰਾਣੇ ਸਿੱਕੇ ਮਿਊਜ਼ੀਅਮ ਵਿੱਚ ਅੱਜ ਵੀ ਸਾਰਾ ਕੁਛ ਸੰਭਾਲਿਆ ਪਿਆ